ਹੈਲੋ ਤੁਸੀਂ ਰਸੋਈ ਢਾਬੇ ਤੋਂ ਗੱਲ ਕਰ ਰਹੇ ਹੋ ਜੀ ਮੈਂ ਸਿਲਵਰ ਸਿਟੀ ਕਲੋਨੀ ਮਾਨਸਾ ਰੋਡ ਬਠਿੰਡਾ ਤੋਂ ਗੱਲ ਕਰ ਰਹੀ ਹਾਂ ਜੀ ਮੈਂ ਖਾਣੇ ਦਾ ਓਰਡਰ ਦੇਣਾ ਚਾਹੁੰਦੀ ਹਾਂ ਕੀ ਤੁਸੀਂ ਮੇਰੇ ਓਰਡਰ ਕੀਤੇ ਖਾਣੇ ਨੂੰ ਅੱਜ ਦਿਨ ਵੀਰਵਾਰ ਤਰੀਕ ਤੇਰ੍ਹਾਂ ਜੂਨ ਦੋ ਹਜ਼ਾਰ ਚੌਵੀ ਨੂੰ ਸਾਡੇ ਘਰ ਜੋ ਕਿ ਮਕਾਨ ਤਿੰਨ ਸੌ ਗਿਆਰ੍ਹਾਂ ਸਿਲਵਰ ਸਿਟੀ ਕਲੋਨੀ ਮਾਨਸਾ ਰੋਡ ਬਠਿੰਡਾ ਵਿਖੇ ਹੈ ਉੱਥੇ ਦੁਪਹਿਰ ਦੋ ਵਜੇ ਤੱਕ ਪਹੁੰਚਾ ਸਕਦੇ ਹੋ ਕਿਰਪਾ ਕਰਕੇ ਭੋਜਨ ਦਾ ਓਰਡਰ ਨੋਟ ਕਰ ਲਿਓ ਜੀ ਮੈਨੂੰ ਦੋ ਪਲੇਟ ਸ਼ਾਹੀ ਪਨੀਰ ਇੱਕ ਪਲੇਟ ਦਾਲ ਮੱਖਣੀ ਦਸ ਚਪਾਤੀ ਰਾਇਤਾ ਔਰ ਪੰਜ ਨਾਨ ਦਾ ਓਰਡਰ ਦੇਣਾ ਹੈ ਜੀ ਮੈਂ ਰੇਟ ਐਕਚੁਲੀ ਤੁਹਾਡੇ ਔਨਲਾਈਨ ਪੇਜ ਅਤੇ ਮੈਨਯੂ ਦੇ ਵਿੱਚ ਦੇਖ ਲਿਤੇ ਸੀਗੇ ਤੁਸੀਂ ਪਹਿਲੀ ਵਾਰ ਓਰਡਰ ਕਰਨ ਵਾਲੇ ਕਸਟਮਰ ਨੂੰ ਕੋਈ ਛੂਟ ਜਾਂ ਡਿਸਕਾਊਂਟ ਦਿੰਦੇ ਹੋ ਕਿਉਂਕਿ ਬਾਕੀ ਤਾਂ ਦਿੰਦੇ ਨੇ ਇਸ ਲਈ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਦੇਣਾ ਚਾਹੀਦਾ ਜਿਹੜੇ ਫਸਟ ਟਾਈਮ ਪਹਿਲੀ ਵਾਰ ਤੁਹਾਡੇ ਰੈਸਟੋਰੈਂਟ ਤੋਂ ਓਰਡਰ ਕਰ ਰਹੇ ਆ ਜਾਂ ਤੁਹਾਡੀ ਐਪਲੀਕੇਸ਼ਨ ਤੋਂ ਓਰਡਰ ਕਰ ਰਹੇ ਹੈ ਭੋਜਨ ਦੇ ਤੁਸੀਂ ਮਤਲਬ ਇੱਦਾਂ ਕਰ ਸਕਦੇ ਹੋ ਕਿ ਵੀ ਤੁਸੀਂ ਡਿਲੀਵਰੀ ਚਾਰਜਿਜ ਖਾਣੇ ਦੇ ਵਿੱਚ ਨਾ ਲਗਾਓ ਸਿਰਫ ਭੋਜਨ ਦੇ ਚਾਰਜਿਸ ਲਗਾ ਕੇ ਬਿਲ ਬਣਾ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਇਸ ਗੁਜ਼ਾਰਿਸ਼ ਨੂੰ ਜ਼ਰੂਰ ਮੰਨੋਗੇ ਕਿਰਪਾ ਕਰਕੇ ਖਾਣਾ ਤੁਸੀਂ ਮੇਰੇ ਦਿੱਤੇ ਗਏ ਐਡਰੈਸ ਔਰ ਪਤੇ 'ਤੇ ਹੀ ਡਿਲੀਵਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ